ਬਰਤਨ ਸਾਫ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਸਾਰੇ ਬਰਤਨਾਂ ਨੂੰ ਸ਼ਿੰਕ ਵਿੱਚ ਰੱਖਦੇ ਹਾਂ ਉਸ ਤੋਂ ਬਾਅਦ ਉਹਨਾਂ ਨੂੰ ਪਾਣੀ ਨਾਲ ਸਾਫ ਕਰਕੇ ਤੇ ਤੇਲ ਵਾਲੇ ਬਰਤਨਾਂ ਨੂੰ ਗਰਮ ਪਾਣੀ ਵਿੱਚ ਧੋ ਕੇ ਤੇ ਸਾਬਣ ਜਾਂ ਸਰਫ ਯੂਜ ਕਰਕੇ ਉਹਨਾਂ ਨੂੰ ਅੱਛੀ ਤਰ੍ਹਾਂ ਵੋਸ਼ ਕਰਕੇ ਕਿਸੇ ਬਰਤਨ ਵੀ ਜਾ ਟੋਕਰੀ ਵਿੱਚ ਰੱਖ ਕੇ ਉਹਨਾਂ ਨੂੰ ਮੁੱਧੇ ਕਰਕੇ ਫਿਰ ਰੱਖਦੇ ਆ